ਹਾਂ ਮੈਨੂੰ ਬਲੈਕ ਐਂਡ ਵਾਈਟ ਫੋਟੋਗਰਾਫੀ ਦਾ ਪ੍ਰਯੋਗ ਕਰਨ ਦਾ ਮੌਕਾ ਮਿਲਿਆ ਹੈ ਅਤੇ ਮੈਂ ਇਸ ਨੂੰ ਬਹੁਤ ਹੀ ਪਸੰਦ ਕਰਦੀ ਹਾਂ ਬਲੈਕ ਐਂਡ ਵਾਈਟ ਫੋਟੋਗਰਾਫੀ ਇੱਕ ਵਿਲੱਖਣ ਰੂਪ ਹੈ ਜਿਸ ਵਿੱਚ ਰੰਗਾਂ ਦੀ ਗੁੰਜਾਇਸ਼ ਨਹੀਂ ਹੁੰਦੀ ਇਸ ਨਾਲ ਚਿੱਤਰ ਵਿੱਚ ਵੱਖ ਵੱਖ ਰੂਪ ਅਤੇ ਛਾਵਾਂ ਦੇ ਖੇਡ ਨੂੰ ਜ਼ਿਆਦਾ ਮੱਤ ਮਿਲਦੀ ਹੈ ਰੰਗਾਂ ਦੀ ਘਾਟ ਦੇ ਨਾਲ ਫੋਟੋ ਵਿੱਚ ਇੱਕ ਪ੍ਰਕਾਸ਼ ਅਤੇ ਹਨੇਰੇ ਦਾ ਸੁੰਦਰ ਸੰਤੁਲਨ ਬਣਦਾ ਹੈ ਜੋ ਚਿੱਤਰ ਨੂੰ ਇੱਕ ਅਲੱਗ ਹੀ ਜਾਦੂ ਦੇ ਦ੍ਰਿਸ਼ ਨੂੰ ਪੇਸ਼ ਕਰਦਾ ਹੈ ਮੋਨੋ ਕਰੈਮਿਕ ਚਿੱਤਰਾਂ ਦਾ ਅਪੀਲ ਇਹ ਹੈ ਕਿ ਇਹ ਸਿੱਧੇ ਅਤੇ ਅਸਿੱਧੇ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਗਹਿਰਾਈਆਂ ਅਤੇ ਪਨਾ ਭਾਵਨਾਵਾਂ ਵਿੱਚ ਜਾਂਦੀਆਂ ਹਨ ਰੰਗਾਂ ਦੀ ਉਪਸਥਿਤੀ ਨਾ ਹੋਣ ਨਾਲ ਦਰਸ਼ਕਾਂ ਦਾ ਧਿਆਨ ਪ੍ਰਦਾਨ ਤੌਰ 'ਤੇ ਚਿੱਤਰਾਂ ਦੇ ਅੰਗਾਂ ਰੂਪਾਂ ਅਤੇ ਆਕਾਰਾਂ ਵਿੱਚ ਜ਼ਿਆਦਾ ਜਾਂਦਾ ਹੈ ਇਹ ਜ਼ਿਆਦਾ ਵਿਚਾਰਸ਼ੀਲ ਅਤੇ ਭਾਵਨਾਤਮਕ ਰੂਪ 'ਤੇ ਹੁੰਦੀਆਂ ਹਨ ਬਲੈਕ ਐਂਡ ਵਾਈਟ ਫੋਟੋਗਰਾਫੀ ਚਿੱਤਰ ਨੂੰ ਇੱਕ ਬਹੁਤ ਹੀ ਅਲੱਗ ਰੂਪ ਦਿੰਦੀਆਂ ਹਨ ਇਹ ਕਦੇ ਕਦੇ ਸਮਾਜਿਕ ਅਤੇ ਕਦੇ ਕਦੇ ਇਤਿਹਾਸਿਕ ਮਹੱਤਵ ਰੱਖਣ ਵਾਲੀਆਂ ਹੁੰਦੀਆਂ ਹਨ ਜਦੋਂ ਰੰਗ ਸਿੱਧੇ ਨਹੀਂ ਦਿਖਾਈ ਦਿੰਦੇ ਤਦੋਂ ਖੁਦ ਫੋਟੋ ਵਿੱਚ ਵਿਸ਼ੇਸ਼ਤਾ ਅਤੇ ਦ੍ਰਿਸ਼ਟੀ ਦੀ ਗਹਿਰਾਈ ਹੋ ਜਾਂਦੀ ਹੈ ਜਿਸ ਨਾਲ ਇਹ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ